ਹਾਂਜੀ ਭਾਅ ਜੀ ਮੈਂ ਸੰਜੈ ਸੰਜੀਵ ਭੰਡਾਰੀ ਬੋਲ ਰਿਹਾ ਮੈਂ ਓਲਾ ਕੈਬ ਬੁੱਕ ਕਰਨੀ ਚਾਹੁੰਦਾ ਹਾਂ ਪਟਿਆਲੇ ਜਾਣ ਲਈ ਅਤੇ ਡਰਾਈਵਰ ਦੀ ਕੀ ਰੇਟਿੰਗ ਹੈ ਕੋਈ ਇਸ ਡਰਾਈਵਰ ਦੀ ਫੀਡ ਬਾਰੇ ਬ ਦੱਸੋ ਮੈਨੂੰ ਇਹ ਡਰਾਈਵਰ ਕਿੰਨੀ ਵਾਰ ਪਟਿਆਲੇ ਜਾ ਚੁੱਕਿਆ ਹੈ ਅਤੇ ਕਿੰਨੀ ਰੇਟਿੰਗ ਮਿਲੀ ਹੋਈ ਹੈ ਜੇ ਆਪਾਂ ਲੋਕਲ ਘੁੰਮਣਾ ਹੋਵੇ ਤਾਂ ਕਿਸ ਹਿਸਾਬ ਨਾਲ ਕਿਸ ਰੇਟ 'ਤੇ ਕੈਬ ਪਵੇਗੀ ਪਹਿਲਾਂ ਮੈਂ ਥਾਪਰ ਯੂਨੀਵਰਸਿਟੀ ਪ੍ਰੋਫੈਸਰ ਨੂੰ ਮਿਲਣ ਜਾਣਾ ਹੈ ਉੱਥੇ ਮੈਨੂੰ ਇੱਕ ਘੰਟੇ ਦਾ ਕੰਮ ਹੈ ਫਿਰ ਉਸ ਤੋਂ ਬਾਅਦ ਮੈਂ ਲੀਲਾ ਭਵਨ ਜਾਣਾ ਹੈ ਅਤੇ ਫਿਰ ਮੋਡਲ ਟਾਊਨ ਵਿੱਚ ਮੈਨੂੰ ਬੈਸਟ ਡਰਾਈਵਰ ਚਾਹੀਦਾ ਹੈ ਮੈਨੂੰ ਸਵੇਰੇ ਅੱਠ ਵਜੇ ਆਪਣੇ ਘਰੋਂ ਪਿਕ ਕਰਨਾ ਹੈ ਅਤੇ ਮੈਨੂੰ ਲੱਗਦਾ ਟੋਟਲ ਮਿਲਾ ਕੇ ਪੰਜ ਘੰਟੇ ਲੱਗ ਜਾਣਗੇ ਅਤੇ ਮੈਨੂੰ ਦੱਸੋ ਕਿੰਨਾ ਖਰਚਾ ਆ ਆਏਗਾ